ਭਾਰਤ ਦੇ ਬੋਲੀਵੁੱਡ ਦੇ ਵਿੱਚ ਬਹੁਤ ਸਾਰੇ ਡਾਂਸਰਾਂ ਨੇ ਆਪਣਾ ਪ੍ਰਭਾਵ ਛੱਡਿਆ ਜਿੱਦਾਂ ਕਿ ਅੱਜ ਕੱਲ੍ਹ ਰੈਮੋ ਡਿਸੂਜਾ ਬਹੁਤ ਚੱਲ ਰਿਹਾ ਵਾ ਗੀਤਾ ਮਾਂ ਹੋ ਗਈ ਹੈ ਉਸ ਤੋਂ ਬਾਅਦ ਇੱਕ ਇੰਡੀਅਨ ਮਾਈਕਲ ਜੈਕਸਨ ਹੈਗੇ ਨੇ ਪ੍ਰਭੂ ਦੇਵਾ ਅੱਜ ਕੱਲ੍ਹ ਉਹਨਾਂ ਦਾ ਬਹੁਤ ਜੋਰ ਚੱਲ ਰਿਹਾ ਬਾਲੀਵੁੱਡ ਵਿੱਚ ਕਿਉਂਕਿ ਅੱਜ ਕੱਲ੍ਹ ਸਾਰੇ ਉਸੇ ਚੀਜ਼ ਨੂੰ ਫੌਲੋ ਕਰ ਰਹੇ ਨੇ ਅਤੇ ਅਤੇ ਇਹਦੇ ਭਾਰਤ ਵਿੱਚ ਬੋਲੀਵੁੱਡ ਦੇ ਗਾਣੇ ਜਿੱਦਾਂ ਕਿ ਹਿੰਦੀ ਹਿੰਦੀ ਗਾਣੇ ਹੈਗੇ ਨੇ ਅ ਆਪਣੇ ਅਰੀਜੀਤ ਸਿੰਘ ਦੇ ਹੋ ਗਏ ਨੇ ਨੇਹਾ ਕੱਕੜ ਦੇ ਹੁੰਦੇ ਨੇ ਇਹ ਅੱਜ ਕੱਲ੍ਹ ਦਾ ਯੂਥ ਸੁਣਨਾ ਬਹੁਤ ਪਸੰਦ ਕਰ ਰਿਹਾ ਅਤੇ ਅੱਜ ਕੱਲ੍ਹ ਦੇ ਯੂਥ ਨੂੰ ਜਿੱਦਾਂ ਦੇ ਅੱਜ ਕੱਲ੍ਹ ਦੇ ਲਵ ਸੋਂਗ ਜਾਂ ਲਵ ਟ੍ਰੈਕਸ ਆ ਜਾਂਦੇ ਉਹਨਾਂ ਨੇ ਉਹ ਇਹਨਾਂ ਨੂੰ ਗਾਉਂਦੇ ਨੇ ਅਤੇ ਬੱਚੇ ਅੱਜ ਕੱਲ੍ਹ ਕਾਫੀ ਪਸੰਦ ਕਰਦੇ ਨੇ